ਦਸਤ ਦੇ ਇਲਾਜ ਲਈ ਪਿੰਡਾਂ ਵਿੱਚ ਬਹੁਤ ਜ਼ਿਆਦਾ ਘਰੇਲੂ ਨੁ ਨੁਸਖੇ ਅਪਣਾਏ ਜਾਂਦੇ ਹਨ ਇਨ੍ਹਾਂ ਵਿੱਚ ਜਿਵੇਂ ਕੁਝ ਫੱਕੀਆਂ ਬਣਾ ਕੇ ਘਰ ਦੇ ਵਿੱਚ ਵਰਤੋਂ ਕੀਤੀ ਜਾਂਦੀ ਹੈ ਇਸ ਫੱਕੀ ਵਿੱਚ ਬਹੁਤ ਸਾਰੇ ਘਰੇਲੂ ਜਿਵੇਂ ਅਜਵਾਇਣ ਅਤੇ ਹੋਰ ਲੌਂਗ ਇਲਾਚੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਦੇ ਨਾਲ ਇੱਕ ਫੱਕੀ ਕੁੱਟੀ ਜਾਂਦੀ ਹੈ ਅਤੇ ਉਸਦਾ ਉਸਦਾ ਉਪਯੋਗ ਕਰਨ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਫਾਇਦਾ ਰਹਿੰਦਾ ਹੈ ਵਿਅਕਤੀ ਨੂੰ ਚਾਹੇ ਬੱਚੇ ਤੋਂ ਲੈ ਕੇ ਵੱਡੇ ਤੱਕ ਇਹ ਫੱਕੀ ਦਾ ਇਸਤੇਮਾਲ ਕਰ ਸਕਦੇ ਹਨ ਅਤੇ ਆਂਵਲ਼ੇ ਦੀ ਫੱਕੀ ਵੀ ਬਹੁਤ ਮਸ਼ਹੂਰ ਕੀਤ ਮਸ਼ਹੂਰ ਮੰਨੀ ਜਾਂਦੀ ਹੈ ਆਂਵਲਾ ਸੁਕਾ ਕੇ ਉਹਨਾਂ ਦੀ ਫੱਕੀ ਬਣਾਈ ਜਾਂਦੀ ਹੈ ਅਤੇ ਉਹ ਬੱਚੇ ਤੋਂ ਲੈ ਕੇ ਬ ਬੜੇ ਤੱਕ ਪੇਟ ਸਾਫ ਰੱਖਦੇ ਹਨ ਉਹਨਾਂ ਦਾ ਅਤੇ ਪੇਟ ਪੇਟ ਦੀ ਬਿਮਾਰੀਆਂ ਅਤੇ ਬਹੁਤ ਰੋਗਾਂ ਤੋਂ ਮੁਕਤ ਕੀਤਾ ਜਾਂਦਾ ਹੈ ਉਸ ਫੱਕੀ ਦੁਆਰਾ ਅਤੇ ਬਿਮਾਰੀ ਬਹੁਤ ਘੱਟ ਲੱਗਦੀ ਹੈ ਪੇਟ ਦੀ ਅਤੇ ਪੇਟ ਹਮੇਸ਼ਾ ਸਾਫ ਰਹਿੰਦਾ ਹੈ ਇਸ ਦੀ ਵਰਤੋਂ ਪ ਪਿੰਡਾਂ ਵਿੱਚ ਹਰ ਘਰ ਵਿੱਚ ਦੇਖਣ ਨੂੰ ਮਿਲਦੀ ਹੈ ਅਤੇ ਘਰ ਵਿੱਚ ਇਹ ਨੁਸਖੇ ਅਪਣਾਏ ਜਾਂਦੇ ਹਨ